ਪਹਿਲੇ ਜ਼ਮਾਨੇ ਵਿੱਚ ਖੂਹਾਂ ਹਰ ਥੋ ਕਿਲੋਮੀਟਰ ਜਾਂ ਦੋ ਕਿਲੋਮੀਟਰ ਦੇ ਵੱਖਮੇ 'ਤੇ ਹੁੰਦੇ ਸਨ ਪਰ ਖੂਹਾਂ ਦੇ ਵਿੱਚੋਂ ਪਾਣੀ ਕੱਢਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ ਕਿਉਂਕਿ ਪਹਿਲੋਂ ਖੂਹ ਦੇ ਉੱਤੇ ਪੁਲੀ ਲੱਗੀ ਹੁੰਦੀ ਸੀ ਪੁਲੀ ਦੇ ਉੱਤੇ ਇੱਕ ਰੱਸੀ ਲਿਪਟੀ ਹੁੰਦੀ ਸੀ ਅਤੇ ਉਸ 'ਤੇ ਇੱਕ ਸਿਰੇ ਦੇ ਉੱਤੇ ਬਾਲਟੀ ਇੱਕ ਕੋਈ ਵੀ ਬਾਲਟੀ ਲੋਹੇ ਦੀ ਪਲਾਸਟਿਕ ਦੀ ਬਾਲਟੀ ਬੰਨ੍ਹੀ ਹੁੰਦੀ ਸੀ ਅਤੇ ਇੱਕ ਸੀਰੀ ਸਿਰਾ ਇੱਕ ਜਿਹੜਾ ਖੂਹ 'ਚੋਂ ਪਾਣੀ ਕੱਢਦਾ ਸੀ ਉਹਦੇ ਹੱਥ ਵਿੱਚ ਹੁੰਦਾ ਸੀ ਅਤੇ ਇਹ ਉਹ ਉਸ ਨੂੰ ਬੜਾ ਹੀ ਕੁਛ ਬੜੀ ਮਿਹਨਤ ਕਰਕੇ ਅਤੇ ਬੜੇ ਟਾਈਮ ਲੱਗਣ ਵਾਲਾ ਪ੍ਰੋਸੈਸ ਹੁੰਦਾ ਸੀ ਕਿ ਪਹਿਲੋਂ ਖੂਹ ਦੇ ਵਿੱਚ ਬਾਲਟੀ ਲਟਕਾ ਕੇ ਅਤੇ ਫਿਰ ਦੂਜੇ ਪਾਸੇ ਖੜ੍ਹਾ ਹੋਇਆ ਆਦਮੀ ਉਸ ਬਾਲਟੀ ਨੂੰ ਉਸ ਰੱਸੀ ਨੂੰ ਬਾਲ ਰੱਸੀ ਨੂੰ ਖਿੱਚ ਕੇ ਬਾਲਟੀ ਨੂੰ ਪਾਣੀ ਦੀ ਭਰੀ ਹੋਈ ਬਾਲਟੀ ਨੂੰ ਉੱਪਰ ਖਿੱਚਦਾ ਸੀ ਅਤੇ ਪਰ ਹੁਣ ਉਹ ਮੋਟਰ ਦੇ ਨਾਲ ਸਿੱਧਾ ਹੀ ਖੂਹ ਦੇ ਵਿੱਚ ਪਾਈਪ ਲਗਾ ਦਿੱਤੀ ਜਾਂਦੀ ਹੈ ਅਤੇ ਉਹ ਸਿਧ ਬ ਬਿਜਲੀ ਪਾਸ ਕਰਕੇ ਓਸਨੂੰ ਸਿੱਧਾ ਹੀ ਕਿਸੇ ਬ ਕਿਸੇ ਮੈਨੁਅਲ ਐਫਰਟ ਦੀ ਲੋੜ ਨਹੀਂ ਹੁੰਦੀ